ਸਰਕਾਰ ਸਾਡੇ ਲਈ ਨ ਬਹੁਤ ਸਾਰੇ ਬਿਮਾਰੀਆਂ ਤੋਂ ਬਚਣ ਲਈ ਅਭਿਆਨ ਚਲਾਉਂਦੀ ਹੈ ਜਿਵੇਂ ਟੀ ਵੀ ਵਿੱਚ ਵਾਰ ਵਾਰ ਦੱਸਦੇ ਆ ਉਹ ਕਿ ਸਾਨੂੰ ਵਾਰ ਵਾਰ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਹੱਥ ਸਾਫ਼ ਕਰਨੇ ਚਾਹੀਦੇ ਹਨ ਘਰ ਵੀ ਸਾਫ਼ ਰੱਖਣਾ ਚਾਹੀਦਾ ਹੈ ਜਿਵੇਂ ਪੋਚਾ ਸਾਫ਼ ਲਗਾਉਣਾ ਚਾਹੀਦਾ ਹੈ ਜਿਹਦੇ ਨਾਲ਼ ਸਾਨੂੰ ਬਿਮਾਰੀਆਂ ਨਹੀਂ ਹੁੰਦੀਆਂ ਹੈ ਇਸ ਤੋਂ ਇਲਾਵਾ ਸਕੂਲਾਂ ਕੋਲਜਾਂ ਵਿੱਚ ਸਾਨੂੰ ਜਾਗਰੂਕ ਕਰਨ ਵਾਸਤੇ ਏ ਟੀਮ ਭੇਜੀ ਜਾਂਦੀ ਹੈ ਜਿਹਦੇ ਨਾਲ਼ ਉਹ ਸਾਨੂੰ ਸਿਖਾਉਂਦੇ ਹੈ ਵੀ ਅਸੀਂ ਕਿਵੇਂ ਆਪਣੇ ਆਸੇ ਪਾਸੇ ਨੂੰ ਸਾਫ਼ ਰੱਖਣਾ ਹੈ ਜਿਵੇਂ ਜਿਹੜੇ ਫਾਲਤੂ ਭਾਂਡੇ ਪਏ ਹੁੰਦੇ ਹੈ ਉਹਨਾਂ ਵਿੱਚ ਪਾਣੀ ਨਹੀਂ ਜਮ੍ਹਾਂ ਹੋਣ ਦੇਣਾ ਜਿਹਦੇ ਨਾਲ਼ ਡੇਂਗੂ ਫੈਲਦਾ ਔਰ ਸਾਰਾ ਕੁਛ ਸਾਫ਼ ਰੱਖਣਾ ਜਿਵੇਂ ਆਸੇ ਪਾਸੇ ਦੀ ਆਪਣੀ ਸਫਾਈ ਰੱਖਣੀ ਹੈ ਆਪਣੇ ਸਕੂਲ ਕੋਲਜਾਂ ਨੂੰ ਵੀ ਸਾਫ਼ ਰੱਖਣਾ ਜਿਹਦੇ ਨਾਲ਼ ਸਾਨੂੰ ਅੱਗੇ ਜਾ ਕੇ ਹੋਰ ਕੋਈ ਬਿਮਾਰੀਆਂ ਨਾ ਹੋ ਜਾਣ ਸਭ ਕੁਛ ਠੀਕ ਚੱਲੇ